ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਦਿੱਲੀ ਤੋਂ ਆਇਆ ਹਾਂ ਮੈਂ ਆਪਣੇ ਮਹਿਕਮੇ ਵੱਲੋਂ ਚੰਡੀਗੜ੍ਹ ਕਿਸਾਨ ਭਵਨ ਵਿੱਚ ਮੀਟਿੰਗ ਅਟੈਂਡ ਕਰਨੀ ਹੈ ਜੋ ਕਿ ਮੈਂਨੂੰ ਇਸ ਏਰੀਏ ਬਾਰੇ ਕੁੱਝ ਪਤਾ ਨਹੀਂ ਹੈ ਮੈਨੂੰ ਤੁਸੀਂ ਇਸ ਏਰੀਏ ਦੇ ਲੋਕਲ ਲੱਗਦੇ ਹੋ ਕਿਰਪਾ ਕਰਕੇ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇੱਥੋਂ ਕੈਬ ਜਾਂ ਆਟੋ ਕਿੱਥੋ ਮਿਲਣਗੇ ਮੈਂ ਸਵੇਰ ਦਾ ਬਹੁਤ ਹੀ ਪ੍ਰੇਸ਼ਾਨ ਹੋ ਗਿਆ ਹਾਂ ਮੈਨੂੰ ਕੁੱਝ ਵੀ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਅਤੇ ਮੈਨੂੰ ਕਿਰਪਾ ਕਰਕੇ ਤੁਸੀਂ ਮੇਰੀ ਮਦਦ ਕਰਦੋ ਤਾਂ ਜੋ ਮੈਂ ਇੱਥੋਂ ਕੈਬ ਜਾਂ ਆਟੋ ਲੈ ਕੇ ਨਿਰਧਾਰਤ ਸਮੇਂ 'ਤੇ ਚੰਡੀਗੜ੍ਹ ਪਹੁੰਚ ਸਕਾ ਅਤੇ ਆਪਣੀ ਮੀਟਿੰਗ ਦੇ ਵਿੱਚ ਜਾ ਕੇ ਹਿੱਸਾ ਲੈ ਸਕਾਂ